ਸਾਡੇ ਦੇਸ਼ ਵਿਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਅਤੇ ਉਹਨਾਂ ਤਿਉਹਾਰਾਂ ਵਿੱਚੋਂ ਇੱਕ ਦਿਵਾਲੀ ਦਾ ਤਿਉਹਾਰ ਹੈ ਦਿਵਾਲੀ ਦੇ ਤਿਉਹਾਰ 'ਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਣਾਉਂਦੇ ਹਾਂ ਜਿਵੇਂ ਕਿ ਪਕੌੜੇ ਬਣਾਉਂਦੇ ਹਾਂ ਅਲੱਗ ਅਲੱਗ ਜਿਹੜੇ ਧਰਮਾਂ ਦੇ ਲੋਕ ਅਲੱਗ ਅਲੱਗ ਚੀਜ਼ਾਂ ਬਣਾਉਂਦੇ ਹਾਂ ਹੁਣ ਜੇ ਆਪਾਂ ਯੂਪੀ ਬਿਹਾਰ ਵਾਲਿਆਂ ਦੀ ਸਾਈਡ ਦੀ ਗੱਲ ਕਰੀਏ ਤਾਂ ਉਹ ਕੀ ਕਰਦੇ ਆ ਉਹ ਗੁਜੀਆ ਬਣਾਉਂਦੇ ਹਾਂ ਗੁਜੀਆ ਬਣਾਉਂਦੇ ਹਾਂ ਕਚੋਰੀਆਂ ਬਣਾਉਂਦੇ ਹਾਂ ਅਤੇ ਸਾਡੇ ਇੱਧਰ ਪੰਜਾਬ ਵਿੱਚ ਜ਼ਿਆਦਾਤਰ ਜਲੇਬੀਆਂ ਬਣਾਈਆਂ ਜਾਂਦੀਆਂ ਜਾਂ ਜ਼ਿਆਦਾਤਰ ਪਕੌੜੇ ਬਣਾਏ ਜਾਂਦੇ ਹਾਂ ਅਤੇ ਪਕੌੜੇ ਬਣਾਉਣ ਦੇ ਲਈ ਅਸੀਂ ਕੀ ਕਰਦੇ ਹਾਂ ਪਹਿਲਾਂ ਤਾਂ ਸਾਨੂੰ ਬੇਸਣ ਦੀ ਰਿਕੁਇਰਮੈਂਟ ਹੁੰਦੀ ਆ ਸਾਨੂੰ ਬੇਸਣ ਚਾਹੀਦਾ ਹੁੰਦਾ ਅਤੇ ਅਸੀਂ ਉਹ ਸਾਡੇ ਆਪ ਦੇ ਅਤੇ ਸਵਾਦ 'ਤੇ ਡਿਪੈਂਡ ਹੈ ਕਿ ਅਸੀਂ ਪਕੌੜੇ ਕਿਹੜੇ ਖਾਣੇ ਆ ਫੀ ਆਲੂ ਵਾਲੇ ਖਾਣੇ ਆ ਜਾਂ ਗੋ ਇਕੱਲੇ ਗੋਭੀ ਵਾਲੇ ਖਾਣੇ ਜਾਂ ਬ੍ਰੈਡ ਪਕੌੜੇ ਖਾਣੇ ਜਿੱਦਾਂ ਵੀ ਅਸੀਂ ਅਤੇ ਜੇ ਹੁਣ ਅਸੀਂ ਮਿਕਸ ਪਕੌੜਿਆਂ ਦੀ ਗੱਲ ਕਰੀਏ ਤਾਂ ਮਿਕਸ ਪਕੌੜਿਆਂ ਦੇ ਵਿੱਚ ਹਰ ਇੱਕ ਚ ਸਬਜ਼ੀ ਪਾ ਲਈ ਦੀ ਹੈ ਅਤੇ ਉਹ ਵੀ ਸਾਡੇ 'ਤੇ ਡਿਪੈਂਡ ਹੈ ਕਿ ਅਸੀਂ ਕਿਹੜੀ ਕਿਹੜੀ ਸਬਜ਼ੀ ਪਾਉਣੀ ਆ ਅਤੇ ਪਹਿਲਾਂ ਤਾਂ ਅਸੀਂ ਸਭ ਤੋਂ ਪਹਿਲਾਂ ਪਕੌੜੇ ਬਣਾਉਣ ਦੇ ਲਈ ਕੀ ਕਰਾਂਗੇ ਸ ਬਰੀਕ ਬਾਰੀਕ ਸਬਜ਼ੀਆਂ ਕੱਟ ਲਵਾਂਗੇ ਜੋ ਜੋ ਵੀ ਸਾਨੂੰ ਪਸੰਦ ਆ ਅਸੀਂ ਪਕੌੜਿਆਂ ਦੇ ਵਿੱਚ ਪਾਉਣੀਆਂ ਚਾਹੁੰਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਕਿਆ ਕਰਾਂਗੇ ਜਿਹੜੇ ਕਰਿਆਟੀ ਆ ਕਰਿਆਟੀ ਨੂੰ ਘੋਲ ਲਵਾਂਗੇ ਜ਼ਿਆਦਾ ਉਹਨੂੰ ਗਾੜਾ ਨਹੀਂ ਘੋਲਣਾ ਹੈਗਾ ਉਹਨੂੰ ਪਤਲਾ ਪਤਲਾ ਘੋਲਣਾ ਹੈ ਕਿ ਜਿਹੜਾ ਇੱਕ ਪ੍ਰੋਪਰ ਜਿਹੜੀ ਕੋਟਿੰਗ ਆ ਇੱਕ ਬਾਇੰਡਿੰਗ ਜਿਹੜੀ ਆ ਉਹ ਸਬਜ਼ੀਆਂ 'ਤੇ ਆ ਸਕੇ ਅਤੇ ਉਹਦੇ ਵਿੱਚ ਅਸੀਂ ਜੇ ਜਿਹੜਾ ਲੂਣ ਪਾਉਣਾ ਹੈ ਉਹ ਵੀ ਕੁਆਂਟਿਟੀ ਦੇ ਹਿਸਾਬ ਨਾਲ ਦੇਖ ਕੇ ਪਾਉਣਾ ਹੈ ਅਤੇ ਉਹਦੇ ਤੋਂ ਬਾਅਦ ਇਹਦੇ ਵਿੱਚ ਕੁਛ ਚੀਜ਼ਾਂ ਮੇਨ ਹੁੰਦੀਆਂ ਹੈ ਜਿਵੇਂ ਕਿ ਅਸੀਂ ਉਹਦੇ ਵਿੱਚ ਖੱਟਾਪਨ ਲਿਆਉਣ ਦੇ ਲਈ ਅਨਾਰਦਾਣਾ ਪਾਉਂਦੇ ਹਾਂ ਜੇ ਤੁਸੀਂ ਅਨਾਰਦਾਣਾ ਨਹੀਂ ਪਾਓਗੇ ਤਾਂ ਵੀ ਚੱਲ ਜਾਊਗਾ ਬਟ ਲੂਣ ਮਿਰਚ ਇਹ ਜ਼ਰੂਰੀ ਚੀਜ਼ਾਂ ਹੁੰਦੀਆਂ ਅਤੇ ਕਰਿਆਟੀ ਕਰਿਆਟੀ ਇਹ ਤਿੰਨ ਚੀਜ਼ਾਂ ਜਿਹੜੀਆਂ ਇਹ ਮੇਨ ਆ ਅਤੇ ਉਹਨੂੰ ਤੁਸੀਂ ਭਾਵੇਂ ਦੇਸੀ ਤੇਲ 'ਚ ਤਲ ਲੋ ਭਾਵੇਂ ਰਿਫਾਇੰਡ 'ਚ ਤਲ ਲੋ ਜਿਹਦੇ 'ਚ ਮਰਜ਼ੀ ਤਲ ਲੋ ਤਲ ਲੋ ਉਹ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਕਿੱਦਾਂ ਦੇ ਖਾਣਾ ਚਾਹੁੰਦੇ ਹੈ ਅਤੇ ਉਸ ਤੋਂ ਬਾਅਦ ਜੇ ਤੁਸੀਂ ਉਹਨਾਂ ਨੂੰ ਪਕੌੜਿਆਂ ਨੂੰ ਸੋਫਟ ਰੱਖਣਾ ਚਾਹੁੰਦੇ ਹਾਂ ਮੀਨਸ ਨਰਮ ਰੱਖਰਾ ਨਰਮ ਰੱਖਣਾ ਚਾਹੁੰਦੇ ਆ ਤਾਂ ਤੁਸੀਂ ਉਹਦੇ ਵਿੱਚ ਬੇਕਿੰਗ ਪਾਊਡਰ ਪਾ ਸਕਦੇ ਹਾਂ ਜਾਂ ਇੱਕ ਸਾਡੇ ਕੋਲ ਬੇਕਿੰਗ ਸੋਡਾ ਹੁੰਦਾ ਹੈ ਜਿਹੜਾ ਕਿ ਚੀਜ਼ ਨੂੰ ਫੈਲਾ ਦਿੰਦਾ ਹੈ ਅਤੇ ਉਹ ਇੱਕ ਕੰਮ ਕਰਦਾ ਹੈ ਚੀਜ਼ ਨੂੰ ਨਰਮ ਰੱਖਣ ਦੇ ਵਿੱਚ ਅਤੇ ਜੇਕਰ ਇਹ ਨਹੀਂ ਹੈਗੀ ਕਿ ਇਹ ਜਿਹੜੀ ਨਰਮ ਜਿਹੜੀ ਚੀਜ਼ ਹੈ ਇਹ ਉਦੋਂ ਤੱਕ ਹੀ ਨਮਨ ਨਰਮ ਰਹੂਗੀ ਜਦੋਂ ਤੱਕ ਇਹ ਬਣਦੀ ਬਣਦੀ ਜਾਂ ਬਣ ਕੇ ਨਿਕਲੀ ਹੈ ਬਾਹਰ ਇਹ ਜਿੰਨੇ ਟਾਈਮ ਤੱਕ ਤੁਸੀਂ ਮਰਜ਼ੀ ਰੱਖ ਲਓ ਉਨੇ ਟਾਈਮ ਰੱਖ ਇਹ ਨਰਮ ਨਰਮ ਹੀ ਰਹੂਗੀ